ਮੈਂ ਪੰਜਾਬ ਵਿੱਚ ਰਹਿਣ ਵਾਲੀ ਹਾਂ ਇੱਥੇ ਦੇ ਉੱਥੇ ਬਹੁਤ ਸਾਰੇ ਲੋਕ ਰਹਿਣ ਆਉਂਦੇ ਹਨ ਬਿਆਸ ਵਾਲੇ ਵੀ ਬਹੁਤ ਹੀ ਰਹਿਣ ਆਉਂਦੇ ਹਨ ਇੱਥੇ ਦੀ ਪੰਜਾਬੀ ਵੀ ਇੱਥੇ ਦੇ ਪੰਜਾਬ ਵਿੱਚ ਹੀ ਪੰਜਾਬੀ ਹਿੰਦੀ ਇੰਗਲਿਸ਼ ਹੀ ਜ਼ਿਆਦਾ ਬੋਲੀ ਜਾਂਦੀ ਹੈ ਪਰ ਪਿਛਲੇ ਜ਼ਮਾਨੇ ਵਿੱਚ ਤਾਂ ਜ਼ਿਆਦਾਤਰ ਹਿੰਦੀ ਭਾਸ਼ਾ ਹੀ ਬੋਲੀ ਜਾਂਦੀ ਸੀ ਇਸ ਵਾਰ ਤਾਂ ਪੰਜਾਬੀ ਅਤੇ ਇੰਗਲਿਸ਼ ਹੀ ਬੋਲੀ ਜਾਂਦੀ ਹੈ ਅੱਜ ਕੱਲ੍ਹ ਤਾਂ ਇਸ ਵਾਰ ਹੇ ਹਿੰ ਹਿੰਦੀ ਅਤੇ ਇੰਗਲਿਸ਼ ਪੰਜਾਬੀ ਹੀ ਹਿੰਦੀ ਅਤੇ ਇੰਗਲਿਸ਼ ਹੀ ਚੱਲਦੀ ਆਈ ਹੈ ਅਤੇ ਕਿਤੇ ਨਾ ਕਿਤੇ ਪੰਜਾਬੀ ਦੀ ਪੰਜਾਬੀ ਦੀ ਲੈਂਗੁਏਜ਼ ਘੱਟ ਗਈ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਹਿੰਦੀ ਅਤੇ ਇੰਗਲਿਸ਼ ਹੀ ਬੋਲਦੇ ਹਨ ਇੰਗਲਿਸ਼ ਮੇਰੇ ਕੋਲ ਨੋਟਬੁੱਕ ਤਾਂ ਨਹੀਂ ਹੈ ਇੰਗਲਿਸ਼ ਪੜ੍ਹਨ ਲਈ ਪਰ ਮੈਂ ਇੰਗਲਿਸ਼ ਵੀ ਹੌਲੀ ਹੌਲੀ ਆਪਣੇ ਫ਼ੋਨ ਵਿੱਚ ਹੀ ਸਿੱਖੀ ਹੈ ਮੈਨੂੰ ਇੰਗਲਿਸ਼ ਇੰਨੀ ਨਹੀਂ ਸੀ ਆਉਂਦੀ ਮੈਂ ਫ਼ੋਨ ਵਿੱਚ ਹੀ ਹੌਲੀ ਹੌਲੀ ਸਿੱਖ ਲੈਂਦੀ ਹਾਂ ਮੈਨੂੰ ਪੰਜਾਬੀ ਬੋਲਣਾ ਹੀ ਹਿੰਦੀ ਇੰਗਲਿਸ਼ ਇਹ ਬਹੁਤ ਹੀ ਚੰਗੀ ਤਰ੍ਹਾਂ ਬੋਲ ਲੈਂਦੀ ਹਾਂ ਬੋਲ ਲੈਂਦੀ ਹਾਂ